ਜਿਸ ਤਰ੍ਹਾਂ ਕਿ ਮੈਨੂੰ ਸ਼ੁਰੂ ਤੋਂ ਹੀ ਕਿਤਾਬਾਂ ਦਾ ਪ੍ਰਤੀ ਵੱਡਾ ਸ਼ੌਕ ਰਿਹਾ ਹੈ ਅਤੇ ਮੈਂ ਪਿਛਲੇ ਲੰਬੇ ਸਮੇਂ ਤੋਂ ਕਾਫੀ ਤਰ੍ਹਾਂ ਤਰ੍ਹਾਂ ਦੀਆਂ ਅਲਗ ਅਲਗ ਟੋਪਿਕ 'ਤੇ ਬੁੱਕਸ ਇਕੱਠੀਆਂ ਵੀ ਕੀਤੀਆਂ ਇਸੇ ਟਾਈਮ 'ਤੇ ਮੈਨੂੰ ਹੈਲਥ ਦੇ ਸਬੰਧਿਤ ਬੜਾ ਸ਼ੌਕ ਸੀ ਅਤੇ ਮੈਂ ਹੈਲਥ ਉੱਤੇ ਕੁਛ ਹੋਮਿਓਪੈਥਿਕ ਸੰਬੰਧੀ ਬੁੱਕਸ ਵੀ ਲਿਆ ਲਿਆਂਦੀਆਂ ਜਿਹਨਾਂ ਤੋਂ ਮੈਨੂੰ ਕਾਫੀ ਜਾਣਕਾਰੀ ਮਿਲੀ ਅਤੇ ਮੈਂ ਘਰ ਇੱਕ ਈਵਨ ਇੱਕ ਛੋਟੀ ਹੋਮੋਪੈਥਿਕ ਲੈਬ ਤੱਕ ਬਣਾ ਲਈ ਉਸ ਤੋਂ ਬਾਅਦ ਮੈਂ ਕੁਛ ਯੋਗ ਨਾਲ ਸੰਬੰਧਿਤ ਕਿਤਾਬਾਂ ਇਕੱਠੀਆਂ ਕੀਤੀਆਂ ਉਹਨਾਂ ਨੂੰ ਪੜ੍ਹ ਕੇ ਕਾਫੀ ਜਾਣਕਾਰੀ ਹਾਸਿਲ ਕੀਤੀ ਅਤੇ ਫਿਰ ਜਿਸ ਤਰ੍ਹਾਂ ਕਿ ਮੈਨੂੰ ਥੋੜ੍ਹਾ ਜਿਹਾ ਅਧਿਆਤਮਿਕ ਪੱਖ ਦੇ ਉੱਤੇ ਵੀ ਮੈਂ ਰੱਖਦਾ ਮੈਂ ਆਪਣੀ ਇਸ ਦੀ ਜਾਣਕਾਰੀ ਲੈਣਾ ਚਾਹੁੰਦਾ ਸੀ ਅਤੇ ਇਸ ਸਬੰਧਿਤ ਵਿ ਵਿੱਚ ਮੈਂ ਪਹਿਲੇ ਜਨਰਲੀ ਇੱਧਰ ਜਿਹੜੀਆਂ ਮਾਰਕੀਟ ਅਵੇਲੇਬਲ ਬੁੱਕਸ ਪੜ੍ਹਦਾ ਰਿਹਾ ਮੈਂ ਲੇਕਿਨ ਫਿਰ ਮੈਂ ਹੁਣ ਰੀਸੈਂਟਲੀ ਕੁਛ ਕਿਤਾਬਾਂ ਜਿਹੜੀਆਂ ਅ ਇਸਕੌਨ ਦੇ ਫਾਊਂਡਰ ਆਪਣੇ ਅ ਪ੍ਰਭੂਪਾਧ ਜੀ ਆ ਉਹਨਾਂ ਦੀਆਂ ਲਿਖਿਤ ਬੁੱਕਸ ਪੜ੍ਹੀਆਂ ਜਿਵੇਂ ਕਿ ਭਗਵਤ ਗੀਤਾ ਐਜ਼ ਇੱਟ ਇਜ਼ ਇੱਕ ਉਹਨਾਂ ਦੀ ਵੱਲੋਂ ਰਚਿਤ ਹੈ ਅ ਭਾਗਵਤਮ ਗ੍ਰੰਥ ਔਰ ਇਕ ਉਹਨਾਂ ਦੀ ਬਹੁਤ ਹੀ ਜਿਹੜੀ ਮੈਨੂੰ ਇੱਕ ਛੋਟੀ ਬੁੱਕ ਹੈ ਜਿਹਦੇ ਵਿੱਚ ਉਹਨਾਂ ਨੇ ਬੜੇ ਅੱਛੇ ਢੰਗ ਨਾਲ ਲਾਈਫ ਦੀਆਂ ਮਤਲਬ ਅਧਿਆਤਮ ਨੂੰ ਐਕਸਪਲੇਨ ਕੀਤਾ ਹੈ ਪਰਫੈਕਟ ਕੋਸ਼ਚਨ ਪਰਫੈਕਟ ਆਨਸਰ ਜਿਹਨੂੰ ਪੜ੍ਹ ਕੇ ਮੈਨੂੰ ਇੱਕ ਮਾਨਸਿਕ ਬੜੀ ਸ਼ਾਂਤੀ ਮਿਲੀ ਔਰ ਕਿਉਂਕਿ ਉਸ 'ਚੋਂ ਇੱਕ ਬੜੀਆ ਬੜੀ ਚੀਜ਼ ਸਮਝ ਆਈ ਜੀਵਨ ਦੀਆਂ ਦੁਵਿਧਾਵਾਂ ਨਾਲ ਦੋ ਚਾਰ ਹੋਣ ਵਾਸਤੇ ਉਹਦੇ ਵਿੱਚ ਬੜੇ ਅੱਛਾ ਸਮਝਾਇਆ ਗਿਆ ਸੀ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਇੱਕ ਅੱਛਾ ਮੋੜ ਦੇ ਕੇ ਇੱਕ ਆਪਣੇ ਆਪ ਨੂੰ ਮੁਕਤ ਆਤਮਾ ਬਣਾ ਸਕਦੇ ਹੈ